ਧਰਮ ਲੋਕਾਂ ਨੂੰ ਵਿਸ਼ਵਾਸ ਕਰਨ ਲਈ ਕੁਝ ਦਿੰਦਾ ਹੈ ਦੀ ਭਾਵਨਾ ਪ੍ਰਦਾਨ ਕਰਦਾ ਹੈ ਅਤੇ ਆਮ ਤੌਰ 'ਤੇ ਲੋਕਾਂ ਦੇ ਸਮੂਹ ਨੂੰ ਸਮਾਨ ਵਿਸ਼ੇਸ਼ਤਾਵਾਂ ਨਾਲ ਜੁੜਨ ਦੀ ਪੇਸ਼ਕਸ਼ ਕਰਦਾ ਹੈ ਇਹਨਾਂ ਪਹਿਲੂਆਂ ਦਾ ਮਾਨਸਿਕ ਸਿਹਤ 'ਤੇ ਵੱਡਾ ਪ੍ਰਭਾਵ ਹੋ ਸਕਦਾ ਹੈ ਸਾਨੂੰ ਖੋਜ ਸੁਝਾਅ ਦਿੰਦੀ ਹੈ ਕਿ ਧਾਰਮਿਕਤਾ ਖੁਦਕਰਸ਼ੀ ਦਰਾ ਸ਼ਰਾਬ ਪੀਣ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਘਟਾਉਂਦੀ ਹੈ ਇੱਥੇ ਧਰਮ ਦੇ ਕੁਝ ਮੁੱਖ ਮਾਨਸਿਕ ਸਿਹਤ ਲਾਭ ਹਨ ਜਿਵੇਂ ਕਿ ਭਾਈਚਾਰਾ ਦੂਜੇ ਮੈਂਬਰਾਂ ਨਾਲ ਸਮਾਜਿਕ ਸੰਬੰਧਾਂ ਦੀ ਦੀ ਸ਼ੁਰੂਆਤ ਰਹਿਣ ਦੇ ਕਰਦਾ ਹੈ ਇਸ ਸਮੂਹ ਨਾਲ ਸੰਬੰਧਿਤ ਹੋਣ ਦੀ ਭਾਵਨਾ ਪੈਦਾ ਕਰਦਾ ਹੈ ਭਰੋਸੇਮੰਦ ਅਤੇ ਸਿੱਖਿਅਤ ਸਮਾਜਿਕ ਮਨਸੂਲੀਅਤ ਦੀ ਪੇਸ਼ਕਸ਼ ਕਰਦਾ ਹੈ ਮੁਸ਼ਕਿਲ ਜੀਵਨ ਦੀਆਂ ਸਥਿਤੀਆਂ ਨਾਲ ਸਿੰਜਣ ਵਿੱਚ ਲੋਕਾਂ ਦੀ ਮਦਦ ਕਰਦਾ ਹੈ ਜਿਵੇਂ ਕੀ ਕਿਸੇ ਅਜੀਜ ਦੀ ਮੌਤ ਦੀ ਰਸਮ ਬਣਤਰ ਨਿਯਮਤਾ ਅਤੇ ਭਵਿੱਖਬਾਣੀ ਪ੍ਰਦਾਨ ਕਰਦਾ ਹੈ ਆਰਾਮ ਕਰਨ ਦੇ ਨਾਲ ਨਾਲ ਛੁੱਟੀਆਂ ਦੇ ਸਾਲ ਦੇ ਹੋਰ ਖਾਸ ਸਮਿਆਂ ਦਾ ਆਗਿਆ ਦਿੰਦਾ ਹੈ ਮਨ ਅਤੇ ਸਰੀਰ ਲਈ ਸਿਹਤਮੰਦ ਅਭਿਆਸਾ ਨੂੰ ਵੀ ਸ਼ਾਮਿਲ ਕਰਦੀ ਹੈ ਜੋ ਮਾਨਸਿਕ ਸਿਹਤ 'ਤੇ ਭਾਵਨਾਤਕ ਤੰਦਰੁਸਤੀ ਨੂੰ ਸਕਾਰਤਮਕ ਤੌਰ 'ਤੇ ਪ੍ਰਭਾਵਿਤ ਕਰਦੀ ਹੈ ਇੱਥੇ ਉਹਨਾਂ ਵਿੱਚੋਂ ਕੁਝ ਲਾਭ ਵੀ ਹਨ ਇਹ ਇੱਕ ਵਿਅਕਤੀ ਨੂੰ ਆਪਣੇ ਅੰਦਰ ਵੇਖਣ ਅਤੇ ਸਮਝਣ ਵਿੱਚ ਮਦਦ ਕਰਦੀ ਹੈ ਜਦੋਂ ਕਿ ਬਾਕੀ ਦੇ ਸੰਸਾਰ ਵਿੱਚ ਕਿਵੇਂ ਫਿੱਟ ਹੁੰਦੇ ਹਨ ਇਸ ਬਾਰੇ ਵਧੇਰੇ ਜਵਾਬ ਦਾ ਪਤਾ ਲਗਾਉਂਦੇ ਹਨ ਦੂਜੇ ਸ਼ਬਦਾਂ ਵਿੱਚ ਇਹ ਲੋਕਾਂ ਨੂੰ ਜੀਵਨ ਦੇ ਆਦੀ ਉਹਨਾਂ ਵਿਆਖਿਆ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡਾ ਧਰਮ ਸਾਨੂੰ ਸਿਹਤ ਸੰਭਾਲ ਬਾਰੇ ਬਹੁਤ ਕੁਝ ਸਿਖਾਉਂਦਾ ਹੈ ਅਤੇ ਕਈ ਤਰ੍ਹਾਂ ਦੇ ਤਰੀਕੇ ਵੀ ਹਨ ਜੋ ਸਾਡੀ ਸਿਹਤ ਦਾ ਧਿਆਨ ਅਤੇ ਮਾਨਸਿਕ ਸਿਹਤ ਦਾ ਧਿਆਨ ਵੀ ਰੱਖਦੇ ਹਨ ਜਿਸ ਦੇ ਨਾਲ ਸਾਨੂੰ ਸ਼ ਸ਼ਾਂਤੀ ਪ੍ਰਦਾਨ ਹੁੰਦੀ ਹੈ